ਸਾਡੇ ਖੇਤਰ ਵਿੱਚ ਕਲਿਆਣ ਥੀਏਟਰ ਫਿਲਮਾਂ ਲਈ ਬਹੁਤ ਮਸ਼ਹੂਰ ਹੈ ਮੈਂ ਉੱਥੇ ਚਾਰ ਵਾਰ ਗਈ ਹਾਂ ਅਤੇ ਉੱਥੇ ਦਾ ਐਂਟਰੰਸ ਬਹੁਤ ਜ਼ਿਆਦਾ ਵਧੀਆ ਹੈ ਅਤੇ ਉੱਥੇ ਫਿਲਮ ਦੇਖਣ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਮੈਂ ਹਮੇਸ਼ਾਂ ਆਪਣੀ ਸਹੇਲੀਆਂ ਨਾਲ ਫਿਲਮ ਦੇਖਣ ਜਾਂਦੀ ਹਾਂ